ਉੱਤਰ ਭਾਰਤ ਅਤੇ ਦੱਖਿਮ ਭਾਰਤ ਵਿੱਚ ਬਹੁਤ ਫਰਕ ਹੈ ਉੱਤਰ ਭਾਰਤ ਦੇ ਵਿੱਚ ਅਲੱਗ ਅਲੱਗ ਬਹੁਤ ਸਟੇਟਾਂ ਆਉਂਦੀਆਂ ਹੈ ਅਤੇ ਅਸੀਂ ਵੀ ਉੱਤਰ ਭਾਰਤ ਵਿੱਚ ਹੀ ਰਹਿੰਦੇ ਹਨ ਰਹਿੰਦੇ ਹਾਂ ਅਤੇ ਉੱਤਰ ਭਾਰਤ ਦੇ ਵਿੱਚ ਜ਼ਿਆਦਾਤਰ ਪੰਜਾਬ ਹਰਿਆਣਾ ਆਉਂਦਾ ਏ ਅਤੇ ਦੱਕ ਦਕਸ਼ਿਣ ਭਾਰਤ ਵਿੱਚ ਜ਼ਿਆਦਾਤਰ ਤੇਲੰਗਾਨਾ ਆਂਧਰਾ ਪ੍ਰਦੇਸ਼ ਤਾਮਿਲਨਾਡੂ ਕੇਰਲਾ ਕਰਨਾਟਕਾ ਵਰਗੀਆਂ ਸਟੇਟਾਂ ਆਉਂਦੀਆਂ ਨੇ ਅਤੇ ਇੱਥੇ ਬਹੁਤ ਜ਼ਿਆਦਾ ਫਰਕ ਹੈ ਉੱਤਰ ਭਾਰਤ ਅਤੇ ਦਖਸ਼ਿਨ ਭਾਰਤ ਦੇ ਵਿੱਚ ਟੋਟਲੀ ਫਰਕ ਆ ਟੋਟਲੀ ਫਰਕ ਆ ਦਖਸ਼ਿਨ ਭਾਰਤ ਦੇ ਵਿੱਚ ਲੋਕ ਬੜੇ ਅਲੱਗ ਅਲੱਗ ਤਰੀਕੇ ਦੇ ਭਾਸ਼ਾ ਬੋਲਦੇ ਆ ਜਿਵੇਂ ਕਿ ਉੱਥੇ ਤਾਮਿਲਨਾਡੂ ਤੇਲੰਗਾਨਾ ਬੋਲਦੇ ਆ ਅਤੇ ਜ਼ਿਆਦਾਤਰ ਇੰਗਲਿਸ਼ ਨੂੰ ਪ੍ਰੈਫਰੈਂਸ ਦਿੰਦੇ ਆ ਅਤੇ ਹਾਈ ਕੁਆਲੀਫਿਕੇਸ਼ਨ ਵੀ ਉਹ ਅਲੱਗ ਅਲੱਗ ਲੈਂਗੁਏਜ ਦੇ ਵਿੱਚ ਕਰਦੇ ਆ ਕਿਵੇਂ ਉਰਦੂ ਵਗੈਰਾ ਵੀ ਹੋ ਗਈ ਤੇਲੰਗਾਨਾ ਹੋ ਗਈ ਅਤੇ ਪੰਜਾਬ ਪਰ ਕਿਹੜਾ ਦੂਜਾ ਭਾਰਤ ਆ ਉਹਦੇ ਵਿੱਚ ਜ਼ਿਆਦਾਤਰ ਪੰਜਾਬੀ ਜਾਂ ਹਿੰਦੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਆ ਕਿਉਂਕਿ ਉਹਨਾਂ ਦੀ ਮਾਂ ਬੋਲੀ ਆ ਅਤੇ ਓਹ ਜ਼ਿਆਦਾਤਰ ਓਹ ਆਪਣੀ ਮਾਂ ਬੋਲੀ ਨੂੰ ਹੀ ਸਪੋਰਟ ਕਰਦੇ ਆ ਅਤੇ ਇੱਥੇ ਇਹਨਾਂ ਦੇ ਭੋਜਨ ਦੀ ਗੱਲ ਕੀਤੀ ਜਾਵੇ ਭੋਜਨ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਆ ਕਿਹੜਾ ਦਕਸ਼ਿਨ ਭਾਰਤ ਆ ਉੱਥੇ ਜ਼ਿਆਦਾਤਰ ਸਪਾਈਸੀ ਖਾਣਾ ਪਸੰਦ ਕਰਦੇ ਆ ਅਤੇ ਉਹ ਜ਼ਿਆਦਾਤਰ ਉਹਨਾਂ ਦਾ ਮੇਨ ਡਿਸ਼ ਵਗੈਰਾ ਡੋਸਾ ਹੀ ਹੁੰਦੀ ਆ ਅਤੇ ਉਹ ਆਪਣਾ ਜ਼ਿਆਦਾਤਰ ਖਾਣ ਪੀਣ ਦਾ ਸਮਾਨ ਪੱਤੇ ਉੱਪਰ ਰੱਖ ਕੇ ਖਾਣਾ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੂੰ ਧੋ ਦੀ ਧੋਣ ਦੀ ਲੋੜ ਨਹੀਂ ਪੈਂਦੀ ਅਤੇ ਚੱਕ ਕੇ ਸਿੱਟ ਸਕਦੇ ਆ ਪਰ ਕਿਹੜੇ ਭਾਰਤੀ ਕਿਹੜੇ ਇੱਧਰ ਹਰਿਆਣਾ ਅਤੇ ਪੰਜਾਬ ਵਾਲੇ ਲੋਕ ਆ ਅਤੇ ਉਹ ਆਪਣੇ ਭਾਂਡਿਆਂ 'ਤੇ ਹੀ ਖਾਣਾ ਪਸੰਦ ਕਰਦੇ ਆ ਅਤੇ ਕੱਪੜੇ ਦਾ ਵੀ ਬਹੁਤ ਫਰਕ ਆ ਉੱਥੇ ਜ਼ਿਆਦਾਤਰ ਲੋਕ ਸਾੜੀਆਂ ਹੀ ਪਾਉਂਦੇ ਆ ਪਰ ਇੱਥੇ ਜ਼ਿਆਦਾਤਰ ਸੂਟ ਪੈਂਟਾ ਹੀ ਚੱਲਦੀਆਂ ਨੇ ਅਤੇ ਉੱਥੇ ਜ਼ਿਆਦਾ ਬਹੁਤ ਫਰਕ ਹੈ ਅਤੇ ਉੱਥੇ ਉੱਥੇ ਜ਼ਿਆਦਾਤਰ ਲੋਕਾਂ ਨੇ ਆਪਣੇ ਲੱਕੜ ਦੇ ਘਰ ਬਣਾਏ ਆ ਉਹ ਠੰਡੇ ਰਹਿੰਦੇ ਆ ਅਤੇ ਇੱਥੇ ਜ਼ਿਆਦਾਤਰ ਲੋਕ ਸਿਮੰਟ ਵਾਲੇ ਘਰ ਬਣਾਉਂਦੇ ਆ ਕਿ ਉਹ ਪੱਕੇ ਹੋਣ ਅਤੇ ਇੱਥੇ ਅਲੱਗ ਅਲੱਗ ਭਾਸ਼ਾ ਬੋਲੀਆਂ ਜਾਂਦੀਆਂ ਉਹਨਾਂ ਨਾਲੋਂ ਅਤੇ ਉੱਥੇ ਫਰਕ ਆ ਅਤੇ ਮੌਸਮ ਦੀ ਗੱਲ ਕੀਤੀ ਜਾਵੇ ਮੌਸਮ ਵੀ ਉੱਧਰ ਦਾ ਠੰਡਾ ਹੈ ਇੱਧਰ ਨਾਲੋਂ